ਹੈਲੋ ਹਾਂਜੀ ਮੈਮ ਮੀਤ ਇਲੈਕਟ੍ਰੀਸ਼ਨ ਸੇ ਬਾਤ ਕਰ ਰੇ ਹੋ ਆਪਕਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਹਾਂਜੀ ਮੈਮ ਆਪਣੇ ਕੋਲ ਇੱਕ ਤਾਂ ਲਾਈਟ ਦੇ ਰਿਲੇਟਡ ਬੱਲਬ ਆ ਜਾਂਦੇ ਹੈ ਇੱਕ ਟਿਊਬ ਆ ਜਾਂਦੀਆਂ ਹੈ ਦੂਸਰੇ ਕੋਈ ਐੱਲ ਈ ਡੀ ਬੱਲਬ ਆ ਜਾਂਦੇ ਹੈ ਕੋਈ ਇੱਕ ਤਾਂ ਹੁੰਦੀਆਂ ਹੈ ਉਹ ਵਾਲੀਆਂ ਆ ਜਾਂਦੀਆਂ ਹੈ ਤੁਸੀਂ ਸਾਨੂੰ ਦੱਸ ਦਿਓ ਕਿਸ ਤਰੀਕੇ ਦੀਆਂ ਲਵਾਣੀਆਂ ਤੁਹਾਨੂੰ ਕਿਸ ਲਈ ਲਾਈਟ ਚਾਹੀਦੀ ਹੈ ਸਟੱਡੀ ਰਿਲੇਟਡ ਚਾਹੀਦੀ ਹੈ ਜਾਂ ਕੀ

ਓਕੇ ਹਾਂਜੀ ਉਹ ਮੈਂ ਹਾਂ ਮੈਮ ਆਪਣੇ ਕੋਲ ਵੱਧ ਬੜੀ ਵਧੀਆ ਕਵਾਲਿਟੀ ਦੇ ਨਵੇਂ ਹੀ ਹੁਣ ਆਏ ਨੇ ਮਤਲਬ ਡੈਕੋਰੇਸ਼ਨ ਦਾ ਮਟੀਰੀਅਲ ਇਲੈਕਟ੍ਰੀਸ਼ਨ ਮਟੀਰੀਅਲ ਸਲਾਈਡ ਬਹੁਤ ਵਧੀਆ ਨੇ ਵਿੱਚ ਵਿੱਚ ਫਿਕਸ ਹੋ ਜਾਂਦੀਆਂ ਦੁਬਾਰਾ ਅਤੇ ਆਪਣੇ ਉੱਪਰ ਪਤਾ ਵੀ ਚਲਦਾ ਅਤੇ ਉਨ੍ਹਾਂ ਦਾ ਸਿਰਫ਼ ਜਿਹੜੀ ਲਾਈਟ ਹੈ ਉਹ ਬਾਹਰ ਆਵੇਗੀ ਅਤੇ ਘੱਟ ਖਰਚੇ 'ਤੇ ਉਹ ਤੁਹਾਨੂੰ ਥੋੜ੍ਹਾ ਪੈ ਜਾਵੇਗੀ ਹਾਂਜੀ ਮੈਮ ਤੁਸੀਂ ਅ ਇੱਕ ਨਵੇਂ ਐੱਲ ਈ ਡੀ ਬੱਲਬ ਆਏ ਹੈ ਤੁਸੀਂ ਫੋਰ ਸਾਈਡ ਉਹ ਹੀ ਜੋਆਇੰਟ ਕਰਵਾ ਲਿਓ ਬਹੁਤ ਵਧੀਆ ਉਹਦੇ ਨਾਲ ਫੋਰ ਸਾਈਡ ਹੋਵੇਗਾ ਤੁਆਡਾ ਕੋਈ ਵੀ ਮਤਲਬ ਪਰਛਾਵਾਂ ਹੈ ਉਹ ਉੱਪਰ ਨਹੀਂ ਆਵੇਗਾ ਇਹਦੇ ਨਾਲ ਹਾਂਜੀ ਹਾਂਜੀ ਆਪਣੇ ਕੋਲ ਸਾਰੀ ਕੰਪਨੀ ਦੇ ਬੱਲਬ ਹੈਗੇ ਹੈ ਤੁਸੀਂ ਦੱਸ ਦਿਓ ਕਿਹੜੀ ਕੰਪਨੀ ਚਾਹੀਦੀ ਆਪਾਂ ਸਾਰੇ ਮਤਲਬ ਬਜਾਜ ਸਾਰੇ ਕੰਪਨੀ ਦੇ ਰੱਖਦੇ ਹਾਂ ਆਪਣਾ ਮਤਲਬ ਜਿਹੜੇ ਬੱਲਬ ਹੈ ਉਹ ਸਟਾਟਿੰਗ ਛੋਟੇ ਐੱਲ ਈ ਡੀ ਬੱਲਬ ਹੈ ਜਿਹੜੇ ਉਹ ਧਾਤੋਂ ਸਟਾਟਿੰਗ ਟੂ ਹੰਡਰਡ ਰੁਪੀਜ਼ ਹੈ ਅਤੇ ਜਿਵੇਂ ਜਿਵੇਂ ਮਤਲਬ ਕੁਆਲਟੀ ਵਧੀਆ ਤੁ ਤੁਹਾਨੂੰ ਚਾਹੀਦੀ ਤਾਂ ਮੈਮ ਥੋੜ੍ਹੇ ਮਤਲਬ ਪੰਜ ਹਜ਼ਾਰ ਪਲੱਸ ਹੈ ਹਜ਼ਾਰ ਪਲੱਸ ਇੱਥੋਂ ਤੱਕ ਆ ਜਾਣਗੇ ਬਾਕੀ ਦੂਸਰਾ ਜੇ ਵਾਇਰ ਦਾ ਵਿੱਚ ਜਿਹੜੇ ਤੁਸੀਂ ਡੈਕੋਰੇਸ਼ਨ ਦਾ ਕਹਿ ਰਹੇ ਹੋ ਉਹ ਮੀਟਰ ਦੇ ਹਿਸਾਬ ਨਾਲ ਲੱਗੇਗਾ ਨਹੀਂ ਅਸੀਂ ਮੈਡਮ ਵਰਕਰ ਰੱਖੇ ਹੋਏ ਆ ਉਹ ਕੰਮ ਕਰਦੇ ਹੈ ਉਹ ਆਉਣਗੇ ਨਹੀਂ ਨਹੀਂ ਮੈਮ ਕੋਈ ਐਕਸਟਰਾ ਚਾਰਜਸ ਨਹੀਂ ਤੁਸੀਂ ਬਸ ਆਪਣਾ ਅਡਰੈਸ ਦੱਸ ਦਿਓ ਤੁਸੀਂ ਸਾਨੂੰ ਅਸੀਂ ਦੱਸ ਦਾਂਗੇ ਤੁਹਾਡੇ ਕੋਲ ਔਨਲਾਈਨ ਭੇਜ ਦਾਂਗੇ ਕਿਹੜੀ ਕੰਪਨੀ ਦਾ ਤੁਸੀਂ ਚਾਏ ਚਾਹੀਦਾ ਤੁਸੀਂ ਦੱਸ ਦਿਓ ਅਸੀਂ ਤੁਹਾਨੂੰ ਚਾਰਜਸ ਦੱਸ ਦਾਂਗੇ ਕਿੰਨੇ ਹੋਣਗੇ ਹਾਂਜੀ ਹਾਂਜੀ ਸਾਰੀ ਕੰਪਨੀਆਂ ਦੇ ਮਿਲ ਜਾਣਗੇ ਓਕੇ